ਹੈਲੋ ਹਾਂਜੀ ਸਰ ਹਾਂਜੀ ਸਰ ਮੈਂ ਕੈਬ ਬੁੱਕ ਕੀਤੀ ਸੀਗੀ ਹਾਂਜੀ ਹਾਂਜੀ ਸਰੋਜ ਰਾਨੀ ਸਰ ਮੈਂ ਆਪਣੇ ਘਰ ਤੋਂ ਕਾਲਜ ਤੱਕ ਜਾਣਾ ਸੀਗਾ ਅਤੇ ਕੀ ਕਹਿੰਦੇ ਮੈਂ ਕੰਪਲੇਂਟ ਕਰਨੀ ਸੀਗੀ ਕਿ ਡਰਾਈਵਰ ਜੋ ਹੈ ਵਧੀਆ ਤਰੀਕੇ ਨਾਲ ਨਹੀਂ ਚਲਾ ਰਹੇ ਸੀਗੇ ਅਤੇ ਜਿਹੜਾ ਪੇਮੈਂਟ ਦਾ ਮੋਡ ਹੈਗਾ ਉਹ ਵੀ ਮਤਲਵ ਮੈਂ ਔਫਲਾਈਨ ਚੂਜ਼ ਕੀਤਾ ਸੀਗਾ ਪਰ ਉਹਨਾਂ ਨੇ ਕਿਹਾ ਵੀ ਨਹੀਂ ਔਫਲਾਈਨ ਦੀ ਓਪਸ਼ਨ ਹੈ ਹੀ ਨਹੀਂ ਹਾਂਜੀ ਸਰ ਪਤਾ ਨੀ ਸਰ ਹੁਣ ਮੈਂ ਕੰਪਲੇਨ ਕਰਨੀ ਸੀਗੀ ਅਤੇ ਤੁਸੀਂ ਮੇਰੀ ਕੰਪਲੇਂਟ ਸੁਣ ਲਓ ਇਦਾਂ ਇਦਾਂ ਕਰਕੇ ਗੱਲ ਹੋਈ ਹੈ ਸਰ ਸਰ ਐਕਚੁਲੀ ਜਦੋਂ ਪਿਕ ਕਰਨ ਆਏ ਠੀਕ ਹੈ ਮਤਲਬ ਮੈਂ ਉੱਥੇ ਖੜੀ ਸੀਗੀ ਚਲੋ ਮੈਂ ਬੈਠ ਗਈ ਉਸ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਜਦੋਂ ਰਸ਼ ਹੁੰਦਾ ਹੈ ਉਹਨਾਂ ਨੇ ਮਤਲਬ ਇੰਨੀ ਤੇਜ਼ ਗੱਡੀ ਚਲਾਈ ਐਂਡ ਆਲ ਸਭ ਦੇ ਮਤਲਬ ਵਿੱਚ ਵੱਜਣ ਤੋਂ ਬਚਿਆ ਇੱਦਾਂ ਕਰਕੇ ਫਿਰ ਉਸ ਤੋਂ ਬਾਅਦ ਜਦੋਂ ਲਾਸਟ ਵਿੱਚ ਮੈਂ ਕੰਪਲੇਂਟ ਕੀਤੀ ਨਾ ਬੋਲਿਆ ਇਹਨਾਂ ਨੇ ਸੁਣੀ ਨਹੀਂ ਅਤੇ ਮੈਂ ਕਿਹਾ ਚਲੋ ਪੇਮੈਂਟ ਕਰ ਦਿੰਦੇ ਹਾਂ ਤਾਂ ਉਹ ਕਹਿੰਦੇ ਵੀ ਇੱਦਾਂ ਕਰਕੇ ਪੇਮੈਂਟ ਹੋਣੀ ਹਾਂਜੀ ਸਰ ਹਾਂਜੀ ਸਰ ਮੈਨੂੰ ਹੁਣ ਅਰੇਂਜ ਕਰਕੇ ਦੇਣੀ ਪਈ ਸਰ ਤਿੰਨ ਸੌ ਸਰ ਇਹ ਕਿ ਕੰਪਲੇਨ ਜਿਹੜੀ ਹੈਗੀ ਮਤਲਬ ਉਹ 'ਤੇ ਐਕਸ਼ਨ ਲੀਤਾ ਜਾਵੇ ਅਤੇ ਅੱਗੇ ਤੋਂ ਇੱਦਾਂ ਦਾ ਡਰਾਈਵਰ ਨਾ ਹੀ ਰੱਖਣ ਕਿ ਕਰਕੇ ਚਲਾਉਣ ਗੱਡੀ ਅਤੇ ਪੇਮੈਂਟ ਦਾ ਵੀ ਕੰਡੀਸ਼ਨ ਤਾਂ ਠੀਕ ਸੀ ਸਰ ਪਰ ਉਹਨਾਂ ਨੂੰ ਮੈਂ ਕਿਹਾ ਸੀ ਜਲਦੀ ਜਾਣਾ ਉਸ ਚੱਕਰ ਦੇ ਵਿੱਚ ਉਹਨਾਂ ਨੇ ਇੰਨੀ ਤੇਜ਼ ਗੱਡੀ ਚਲਾਈ ਜਾਂਦਾ ਅਤੇ ਸਰ ਨਹੀਂ ਨਹੀਂ ਸਰ ਉੱਦਾਂ ਤਾਂ ਕੋਈ ਗੱਲ ਨਹੀਂ ਹੈਗੀ ਬਟ ਥੋੜ੍ਹਾ ਗੱਡੀ ਚਲਾਉਣ ਦਾ ਹੀ ਲੱਗਿਆ ਮੈਨੂੰ ਜ਼ਿਆਦਾ ਤੇਜ਼ ਸੀਗੀ ਲਾਪਰਵਾਹੀ ਵਰਤੀ ਗਈ ਆ ਸਰ ਸਰ ਉਹ ਤਾਂ ਕੋਈ ਪੰਗਾ ਨਹੀਂ ਹੈਗਾ ਪੇਮੈਂਟ ਤਾਂ ਉੰਨੀ ਮਤਲਬ ਦਿੱਤੀ ਆ ਮੈਂ ਮੋਡ ਦਾ ਸੀਗਾ ਵੀ ਆਨਲਾਈਨ ਆਫਲਾਈਨ ਮੋਡ ਦਾ ਸੀਗਾ ਹੁਣ ਮੈਂ ਆਨਲਾਈਨ ਨਹੀਂ ਚਲਾਉਂਦੀ ਸਰ ਹਾਂਜੀ ਸਰ ਕੈਪਟਨ ਕੈਪਟਨ

ਹਾਂਜੀ ਸਰ ਹਾਂਜੀ ਸਰ ਵਨ ਟੂ ਸਿਕਸ ਥਰੀ ਹਾਂਜੀ ਸਰ ਚਾਰ ਨੰਬਰ ਦੀ ਹੀ ਵਾਈਟ ਕਲਰ ਦੇ ਸਰ ਨੰਬਰ ਤਾਂ ਹੁਣ ਮੈਨੂੰ ਇੰਨੀ ਡਿਟੇਲ ਮੈਨੂੰ ਦੇਖਣਾ ਪਊਗਾ ਇੰਨੀ ਯਾਦ ਨਹੀ ਮੈਨੂੰ ਪਰ ਵਾਈਟ ਕਲਰ ਦੀ ਸੀਗੀ ਮਾਰੂਤੀ ਸਜ਼ੂਕੀ ਠੀਕ ਹੈ ਸਰ ਮਾਰੂਤੀ ਸਜ਼ੂਕੀ ਸੀਗੀ ਵਾਈਟ ਕਲਰ ਦੀ ਠੀਕ ਹੈ ਸਰ ਸਰ ਵਾਈਟ ਕਲਰ ਦੀ ਗੱਡੀ ਸੀਗੀ ਫੋਰ ਸੀਟਰ ਮਾਰ ਮਾਰੂਤੀ ਮਾਰੂਤੀ ਸਜ਼ੂਕੀ ਸੀਗੀ ਹਾਂਜੀ ਸਰ ਨੰਬਰ ਪੰਜਾਬ ਦਾ ਲੁਧਿਆਣੇ ਦਾ ਹੀ ਸੀਗਾ ਹਾਂਜੀ ਸਰ ਸਰੋਜ ਰਾਣੀ ਫੋਨ ਨੰਬਰ ਸਰ ਏਟ ਵੰਨ ਫੋਰ ਸਿਕਸ ਨਾਈਨ ਫਾਈਵ ਸੈਵਨ ਟੂ ਸਿਕਸ ਸੈਵਨ ਸਰ ਲਹਾਰੇ ਦਾ ਲੁਧਿਆਣਾ ਲਹਾਰਾ ਹਾਂਜੀ ਠੀਕ ਹੈ ਸਰ ਮੈਂ ਹਾਂਜੀ ਸਰ ਹਾਂਜੀ ਸਰ ਜ਼ਰੂਰ ਜ਼ਰੂਰ ਕਿਉਂਕਿ ਲੇਡੀਜ ਹੁੰਦੀ ਹੈ ਸਰ ਉਹਨਾਂ ਨੇ ਤਾਂ ਜ਼ਰੂਰੀ ਹੁੰਦਾ ਤੁਹਾਨੂੰ ਪਤਾ ਹੀ ਹੁਣ ਠੀਕ ਆ ਸਰ ਥੈਂਕ ਯੂ ਸਰ